ਗਿਆਰਾਂ ਦੋ ਸੌ ਤੇਈ ਚਾਰ ਹਜ਼ਾਰ ਚਾਰ ਸੌ ਪੈਂਹਠ ਬਾਈ ਹਜ਼ਾਰ ਇਕ ਸੌ ਸਤਾਸੀ ਸਤਾਨਵੇਂ ਲੱਖ ਅੱਠ ਹਜ਼ਾਰ ਤਿੰਨ ਸੌ ਪੈਂਹਠ